ਅੱਜ ਕੱਲ੍ਹ ਬੱਚੇ ਜ਼ਿਆਦਾ ਕਰਕੇ ਸਕਰੀਨ ਜਿਵੇਂ ਕਿ ਹੋ ਗਿਆ ਵੀਡੀਓਜ਼ ਗੇਮ ਜਾਂ ਕਿ ਫ਼ੋਨ 'ਤੇ ਹੀ ਗੇਮਾਂ ਖੇਡਦੇ ਨੇ ਬਾਹਰ ਨਹੀਂ ਖੇਡਣ ਜਾਂਦੇ ਜੋ ਕਿ ਉਹਨਾਂ ਲਈ ਬਹੁਤ ਹੀ ਨੁਕਸਾਨਦਾਇਕ ਹੈ ਕਿਉਂਕਿ ਆਪਾਂ ਜਦੋਂ ਕਿ ਫ਼ੋਨ ਦੇਖਦੇ ਹਾਂ ਉਸਦੀ ਸਕਰੀਨ ਨਾਲ਼ ਸਾਡੀਆਂ ਅੱਖਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਸਾਡੀਆਂ ਅੱਖਾਂ ਖ਼ਰਾਬ ਹੋ ਜਾਣ ਸਪੈਕਸ ਲੱਗਣੀਆਂ ਸਟਾਰਟ ਹੋ ਜਾਂਦੀਆਂ ਹਨ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਾਫ਼ੀ ਦੇਖਿਆ ਜਾਵੇ ਤਾਂ ਸਪੈਕਸ ਲੱਗੀਆਂ ਹੋਈਆਂ ਅਤੇ ਉਹ ਜਿਹੜੇ ਸਰੀਰ ਪੱਖੋਂ ਵੀ ਬਹੁਤ ਹੀ ਕਮਜ਼ੋਰ ਹੁੰਦੇ ਆਂ ਜਦੋਂ ਆਪਾਂ ਬਾਹਰ ਖੇਡਦੇ ਹਾਂ ਕੁੱਦਦੇ ਹਾਂ ਤਾਂ ਸਾਡਾ ਸਰੀਰ ਵੀ ਵੱਧਦਾ ਫੁੱਲਦਾ ਹੈ ਅਤੇ ਅਸੀਂ ਕਮਜ਼ੋਰ ਨਹੀਂ ਹੁੰਦੇ ਅਤੇ ਜਦੋਂ ਆਪਾਂ ਫ਼ੋਨ 'ਤੇ ਦੇਖਦੇ ਹਾਂ ਤਾਂ ਫ਼ੋਨ 'ਤੇ ਆਪਾਂ ਇਹ ਵੀ ਦੇਖ ਲੈਂਦੇ ਕਿ ਫੂਡ ਚੱਲ ਰਿਹਾ ਆਪਾਂ ਸਟਰੀਟ ਫੂਡ 'ਤੇ ਜ਼ਿਆਦਾ ਦੇਖ ਲੈਂਦੇ ਹਾਂ ਜ਼ਿਆਦਾ ਕਰਕੇ ਬੱਚਿਆਂ ਨੂੰ ਬਾਹਰ ਹੀ ਖੇਡਣਾ ਕੁੱਦਣਾ ਚਾਹੀਦਾ ਹੈ ਉਹਨਾਂ ਨੂੰ ਪ੍ਰੇਰਿਤ ਕਰਨਾ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਫ਼ੋਨ ਹੈ ਜੋ ਕਿ ਜਾਨਲੇਵਾ ਹੋ ਸਕਦਾ ਕਿਉਂਕਿ ਸਾਡੇ ਦਿਮਾਗ਼ ਨੂੰ ਵੀ ਖ਼ਤਮ ਕਰ ਦਿੰਦਾ ਇੱਕ ਕਿਸਮ ਨਾਲ ਡੈਡ ਕਰਨਾ ਸਟਾਰਟ ਕਰ ਦਿੰਦਾ ਇਹ ਸਾਨੂੰ ਇੱਕ ਨਸ਼ਾ ਬਣ ਜਾਂਦਾ ਫ਼ੋਨ ਦਾ ਜਿਹੜਾ ਕਿ ਲੱਗ ਜਾਂਦਾ ਪਰ ਜਦੋਂ ਅਸੀਂ ਬਾਹਰ ਖੇਡਦੇ ਹਾਂ ਸਾਨੂੰ ਉਸਦਾ ਕੋਈ ਨਸ਼ਾ ਨਹੀਂ ਹੁੰਦਾ ਕਿ ਅਸੀਂ ਖੇਡ ਰਹੇ ਪਰ ਫ਼ੋਨ ਵਿੱਚ ਇੱਕ ਕਿਸਮ ਦਾ ਇੱਕ ਨਸ਼ਾ ਹੀ ਹੁੰਦਾ ਹੈ ਜੋ ਕਿ ਅਸੀਂ ਦੇਖਦੇ ਦੇਖਦੇ ਸਾਨੂੰ ਇਹ ਹੁੰਦਾ ਕਿ ਅਸੀਂ ਇਹ ਦੇਖ ਰਹੇ ਤਾਂ ਥੋੜ੍ਹਾ ਦੇਰ ਹੋਰ ਦੇਖ ਲੇ ਪਰ ਅਸੀਂ ਬਾਹਰ ਇੰਨਾ ਟਾਈਮ ਨਹੀਂ ਦੇਖ ਸਕਦੇ ਕਿਉਂਕਿ ਬਾਹਰ ਥੋੜ੍ਹਾ ਟਾਈਮ ਫ਼ੋਨ ਜਦੋਂ ਦੇਖਣਾ ਵੀ ਸਾਨੂੰ ਥੋੜ੍ਹਾ ਦੇਖਣਾ ਚਾਹੀਦਾ ਪਰ ਸਾਨੂੰ ਬਾਹਰ ਦੀਆਂ ਗੇਮਸ ਆਊਟਡੋਰ ਗੇਮਸ ਜ਼ਿਆਦਾ ਖੇਡਣੀਆਂ ਚਾਹੀਦੀਆਂ ਕਿਉਂਕਿ ਉਹੀ ਸਾਡੇ ਲਈ ਇੱਕ ਸਾਧਨ ਹੈ ਜੋ ਕਿ ਸਾਨੂੰ ਕਮ ਸਿਹਤਮੰਦ ਰਹਿਣ ਲਈ ਸਾਨੂੰ ਬਾਹਰ ਦੀਆਂ ਗੇਮਸ ਖੇਡਣੀਆਂ ਚਾਹੀਦੀਆਂ ਹਨ ਜ਼ਿਆਦਾ ਕਰਕੇ ਫ਼ੋਨ ਘੱਟ ਹੀ ਯੂਜ਼ ਕਰਨਾ ਚਾਹੀਦਾ ਹੈ ਕਿਉਂਕਿ ਫ਼ੋਨ ਜਦੋਂ ਵੀ ਅਸੀਂ ਦੇਖਦੇ ਹਾਂ ਤਾਂ ਸਾਡਾ ਪੜ੍ਹਨ ਨੂੰ ਵੀ ਦਿਲ ਨਹੀਂ ਕਰਦਾ ਜੇਕਰ ਅਸੀਂ ਬਾਹਰੋਂ ਖੇਡ ਕੇ ਆਉਂਦੇ ਫਿਰ ਸਾਡਾ ਪੜ੍ਹਨ ਨੂੰ ਵੀ ਦਿਲ ਕਰਦਾ ਕਿ ਥੋੜ੍ਹੀ ਦੇਰ ਬੈਠ ਕੇ ਪੜ੍ਹ ਲੀ ਇਸ ਲਈ ਸਾਨੂੰ ਫ਼ੋਨ ਦੀ ਜ਼ਰੂ ਮੀਨਿੰਗ ਕਿ ਜਿਹੜੀ ਜਰੂ ਫ਼ੋਨ ਸਾਨੂੰ ਘੱਟ ਦੇਖਣਾ ਚਾਹੀਦਾ ਔਰ ਬਾਹਰ ਦੀਆਂ ਗੇਮਸ ਜ਼ਿਆਦਾ ਖੇਡਣੀਆਂ ਚਾਹੀਦੀਆਂ ਹਨ